ਹੈਲੋ ਹਾਂਜੀ ਮੇਰੀ ਗੱਲ ਓਲਾ ਵਾਲਿਆਂ ਨਾਲ ਹੋ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਾ ਕੱਲ੍ਹ ਇੱਕ ਕੈਬ ਔ ਔਡਰ ਕੀਤੀ ਸੀ ਹਾਂਜੀ ਅ ਮਿਸਟਰ ਸੁਖਜਿੰਦਰ ਸਿੰਘ ਕਾਰ ਦਾ ਨੰਬਰ ਸੀ ਪੀ ਬੀ ਜ਼ੀਰੋ ਟੂ ਸੱਤ ਸੌ ਛਿਆਸੀ ਹਾਂਜੀ ਮੈਂ ਨਾ ਉਨ੍ਹਾਂ ਨੂੰ ਕਿਹਾ ਸੀ ਕਿ ਛੇ ਵਜੇ ਮੇਰੀ ਏਅਰਪੋਰਟ ਦੀ ਫਲਾਈਟ ਸੀ ਅਤੇ ਮੈਂ ਆ ਉਨ੍ਹਾਂ ਨੂੰ ਕਿਹਾ ਸੀ ਕਿ ਚਾਰ ਵਜੇ ਮੇਰੇ ਘਰ ਦੇ ਬਾਹਰ ਖੜ੍ਹੇ ਹੋ ਜਾਣ ਹਾਂਜੀ ਅਤੇ ਮੈਂ ਚਾਰ ਵਜੇ ਹੀ ਉਨ੍ਹਾਂ ਦਾ ਉਨ੍ਹਾਂ ਨੂੰ ਟਾਈਮ ਦਿੱਤਾ ਸੀ ਬਟ ਉਹ ਸਾਢੇ ਪੰਜ ਵਜੇ ਮੇਰੇ ਘਰ ਦੇ ਬਾਹਰ ਆਏ ਜਿਹਦੇ ਕਰਕੇ ਮੈਂ ਏਅਰਪੋਰਟ ਟਾਈਮ ਦੇ ਨਾਲ਼ ਨਹੀਂ ਪਹੁੰਚ ਸਕੀ ਅਤੇ ਮੈਂ ਏਅਰਪੋਰਟ ਹੀ ਸੱਤ ਵਜੇ ਪਹੁੰਚੀ ਉੱਤੋਂ ਰਸਤੇ ਵਿੱਚ ਇੰਨਾ ਕਿ ਜ਼ਿਆਦਾ ਟ੍ਰੈਫ਼ਿਕ ਜਾਮ ਸੀ ਕਿ ਜਿਹਦੇ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਆਈ ਹਾਂਜੀ ਅਤੇ ਜੇ ਤੁਸੀਂ ਆਪਣੇ ਸ ਕਸਟਮਰਸ ਦੇ ਨਾਲ ਇੱਦਾਂ ਹੀ ਲਾਪਰਵਾਹੀ ਕਰੋਗੇ ਤਾਂ ਫਿਰ ਕਿਵੇਂ ਕੋਈ ਭਰੋਸਾ ਕਰਕੇ ਤੁਹਾਡੀ ਕੈਬ ਔਡਰ ਕਰੇਗਾ ਹਾਂਜੀ ਮੈਂ ਭਰੋਸਾ ਕਰਕੇ ਤੁਹਾਡੀ ਕੈਬ ਔਡਰ ਕੀਤੀ ਕਿ ਤੁਸੀਂ ਮੈਨੂੰ ਟਾਈਮ ਨਾਲ ਪਹੁੰਚਾ ਦਿਓਗੇ ਪਰ ਤੁਸੀਂ ਖੁਦ ਹੀ ਨਹੀਂ ਟਾਈਮ ਦੇ ਨਾਲ ਪਹੁੰਚਾਇਆ ਹਾਂਜੀ ਤੁਸੀਂ ਆਪਣੇ ਕੈਬ ਡਰਾਈਵਰ ਨੂੰ ਸਮਝਾਓ ਕਿ ਇੱਦਾਂ ਲਾਪਰਵਾਹੀ ਨਾ ਕਰੇ ਅੱਗੇ ਤੋਂ ਜਿਹਦੇ ਨਾਲ ਵੀ ਕਰੇ ਪੰਚੂਅਲ ਰਹੇ ਆਪਣੇ ਟਾਈਮ ਸਿਰ ਹੀ ਪਹੁੰਚੇ ਹਾਂਜੀ ਤਾਂ ਮੇਰੇ ਇੰਨੇ ਪੈਸੇ ਵੇਸਟ ਹੋਏ ਮੇਰੇ ਟਿਕਟ ਦੇ ਵੀ ਸਾਰੇ ਪੈਸੇ ਵੇਸਟ ਹੋਏ ਸੋ ਮੈਂ ਹੁਣ ਇਹ ਕਹੂੰਗੀ ਕਿ ਮੈਂ ਤੁਹਾਨੂੰ ਜਿਹੜੀ ਐਡਵਾਂਸ ਪੇਮੈਂਟ ਕੀਤੀ ਸੀ ਉਹ ਮੈਨੂੰ ਤੁਸੀਂ ਰਿਫੰਡ ਕਰ ਦਿਓ ਮੈਨੂੰ ਮੇਰੀ ਪੇਮੈਂਟ ਵਾਪਸ ਕਰ ਦਿਓ ਅਤੇ ਜਿਹੜੀ ਪੇਮੈਂਟ ਮੈਂ ਤੁਹਾਨੂੰ ਬਾਅਦ ਵਿੱਚ ਕਰਨੀ ਸੀ ਉਹ ਪੇਮੈਂਟ ਮੈਂ ਫਿਰ ਤੁਹਾਨੂੰ ਨਹੀਂ ਕਰੂੰਗੀ ਕਿਉਂਕਿ ਮੇਰੇ ਟਿਕਟ ਦੇ ਵੀ ਬਹੁਤ ਸਾਰੇ ਪੈਸੇ ਵੇਸਟ ਹੋਏ ਅਤੇ ਇਹ ਵਾਲੇ ਪੈਸੇ ਵੀ ਮੈਂ ਵੇਸਟ ਨਹੀਂ ਕਰੂੰਗੀ ਆਪਣੇ ਹਾਂਜੀ ਓਕੇ ਧੰਨਵਾਦ ਭਾਅ ਜੀ ਓਕੇ ਓਕੇ